ਸਭ ਤੋਂ ਪਹਿਲਾਂ ਮੈਂ ਸੂਰਜਮੁਖੀ ਦੀ ਖੇਤੀ ਵਿੱਚ ਦਿਲਚਸਪ ਦਿਲਚਸਪੀ ਰੱਖਦਾ ਸੀ ਅਤੇ ਹੁਣ ਪੰਜਾਬ ਦੀਆਂ ਫਸਲਾਂ ਜਿਵੇਂ ਕਿ ਕਣਕ ਝੋਨਾ ਕਮਾਦ ਕਪਾਹ ਇਹ ਸਭ ਪੰਜਾਬ ਦੀਆਂ ਫਸਲਾਂ ਹਨ ਅਤੇ ਪੰ ਜਿਵੇਂ ਕਿ ਸਮੇਂ ਸਮੇਂ ਅਨੁਸਾਰ ਬਦਲਦੇ ਮੌਸਮ ਦੇ ਅਨੁਸਾਰ ਫਸਲਾਂ ਦੀ ਵੀ ਅਦਲਾ ਬਦਲੀ ਕੀਤੀ ਜਾਂਦੀ ਹੈ ਜਿਸ ਟਾਈਮ ਜਿਸ ਫਸਲ ਦਾ ਮੌਸਮ ਆਉਂਦਾ ਹੈ ਉਸ ਟਾਈਮ ਉਸ ਫਸਲ ਨੂੰ ਉਗਾਇਆ ਜਾਂਦਾ ਹੈ ਜਿਵੇਂ ਪੰਜਾਬ ਵਿੱਚ ਜ਼ਿਆਦਾਤਰ ਕਣਕ ਝੋਨਾ ਅਤੇ ਕਪਾਹ ਦੀ ਫਸਲ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਗਈ ਹੈ